ਸਿਸਟਰ ਮੈਂ ਨਾ ਇੱਦਾਂ ਰਾਜਸਥਾਨ ਤੋਂ ਆਇਆ ਤੇ ਮੈਂ ਨਾ ਇੱਥੇ ਅੰਮ੍ਰਿਤਸਰ ਪੇ ਮੇਰੀ ਜੋਬ ਲੱਗੀ ਹੈ ਅਤੇ ਮੈਂ ਹੁਣ ਇੱਥੇ ਰਹਿਣਾ ਚਾਹੁੰਦਾ ਵਾ ਆਪਣੇ ਪਰਿਵਾਰ ਨਾਲ ਅਤੇ ਮੈਨੂੰ ਸਿੱਖੀ ਬਾਰੇ ਕੋਈ ਜ਼ਿਆਦਾ ਇਤਿਹਾਸ ਬਾਰੇ ਪਤਾ ਨਹੀਂ ਹੈਗਾ ਤੁਸੀਂ ਮੈਨੂੰ ਇਹਦੇ ਬਾਰੇ ਦੱਸ ਸਕਦੇ ਜੇ ਹੋ ਵੀ ਇਹ ਕੀ ਹੈ ਦੱਸਿਓ ਮੈਮ

ਹਾਂਜੀ ਹਾਂਜੀ

ਹਾਂਜੀ

ਹਾਂਜੀ ਹਾਂਜੀ ਹਾਂਜੀ

ਠੀਕ ਹੈ ਜੀ ਓਕੇ ਓਕੇ ਓਕੇ